ਸਤਿ ਸ਼੍ਰੀ ਅਕਾਲ ਅੰਕਲ ਜੀ ਹੋਰ ਸੁਣਾਓ ਅੰਕਲ ਜੀ ਕਿੱਦਾਂ ਕੀ ਹਾਲ ਚਾਲ ਅੰਕਲ ਜੀ ਮੈਂ ਹੁਸ਼ਿਆਰਪੁਰ ਤੋਂ ਬੋਲਦੀ ਪਈ ਹਾਂ ਮੈਨੂੰ ਆਪਣੀ ਚਾਹੀਦੀ ਖਰੀਦਣੀ ਆ ਮੈਂ ਬਰਾਈਡਲ ਜੂਲਰੀ ਖਰੀਦਣੀ ਆ ਬਰਾਈਡਲ ਜੂਲਰੀ ਖਰੀਦਣੀ ਆ ਕਿੱਦਾਂ ਕਿੱਦਾਂ ਦੇ ਹੋਣਗੇ ਤੁਹਾਡੇ ਕੋਲ ਮਤਲਬ ਗੋਲਡ ਸਿਲਵਰ ਡਾਇਮੰਡ ਆਰਟੀਫਿਸ਼ਲ ਕੀ ਕੀ ਪ੍ਰਾਈਜਡ ਉਹਨਾਂ ਦਾ ਹਾਂਜੀ ਆਰਟ ਆਰਟੀਫਿਸ਼ਅਲ ਅੱਛਾ ਅਤੇ ਮੈਨੂੰ ਗ੍ਰੀਨ ਕਲਰ ਦਾ ਚਾਹੀਦਾ ਹੈ ਅੱਛਾ ਮਤਲਬ ਕੇ ਮ ਟਿੱਕਾ ਵਗੈਰਾ ਸਾਰਾ ਕੁਛ ਵਿੱਚੇ ਆਵੇਗਾ ਮੈਂ ਕਿਹਾ ਉਹਦੇ ਵਿੱਚ ਨੱਥ ਟਿੱਕਾ ਸਾਰਾ ਕੁਛ ਵਿੱਚੇ ਆਵੇਗਾ ਅੱਛਾ ਅਤੇ ਲੈੱਸ ਕਰਕੇ ਕਿੱਦਾਂ ਤੁਸੀਂ ਫਿਰ ਵੀ ਦੱਸੋ ਨਾ ਕਿੰਨਾ ਕੁ ਲੈੱਸ ਕਰੋੋਗੇ ਉਹਦੇ ਨਾਲੋਂ ਜ਼ਿਆਦਾ ਫਿਰ ਵੀ ਅੰਕਲ ਜੀ ਥੋੜ੍ਹਾ ਜਿਹਾ ਹੋਰ ਜ਼ਿਆਦਾ ਲੈੱਸ ਕਰ ਦਿਓ ਚਲੋ ਠੀਕ ਆ ਫਿਰ ਤੁਸੀਂ ਕਰ ਦਿਓ ਵਟਸਐਪ 'ਤੇ ਸੈਂਡ ਸੈਂਪਲ ਵਗੈਰਾ ਫਿਰ ਦੇਖ ਕੇੇ ਫਿਰ ਤੁਹਾਨੂੰ ਦੱਸਦਾਂਂਗੀ ਕਿਹੜਾ ਚਾਹੀਦਾ ਆ ਚਲੋ ਠੀਕ ਠੀਕ ਆ